ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਦੇ ਤਕਨੀਕੀ ਯੁੱਗ ਦੇ ਵਿੱਚ ਕੋਈ ਵੀ ਚੁੱਲ੍ਹੇ 'ਤੇ ਰੋਟੀ ਬਣਾਉਣਾ ਪਸੰਦ ਨਹੀਂ ਕਰਦਾ ਸਾਰੇ ਹੀ ਗੈਸ ਨੂੰ ਪ੍ਰੈਫਰ ਦਿੰਦੇ ਹਨ ਉਹ ਦੇ ਇਹ ਸੋਚਦੇ ਹਨ ਕਿ ਜੇ ਅਸੀਂ ਗੈਸ ਸਲੰਡਰ 'ਤੇ ਕੰਮ ਕਰਾਂਗੇ ਤਾਂ ਸਾਡੀ ਟਾਈਮ ਦੀ ਬੱਚਤ ਹੋਵੇਗੀ ਕਿਉਂਕਿ ਸਾਨੂੰ ਚੁੱਲ੍ਹੇ ਦੇ ਵਿੱਚ ਜ਼ਿਆਦਾ ਟਾਈਮ ਲਗਾਉਣਾ ਪੈਂਦਾ ਹੈਗਾ ਖਾਣਾ ਬਣਾਉਣ ਦੇ ਲਈ ਜਦੋਂ ਕਿ ਗੈਸ ਦੇ ਉੱਤੇ ਸਾਨੂੰ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਕੁਛ ਵੀ ਬਣਾਉਣ ਦੇ ਲਈ ਫਟਾਫਟ ਬਣ ਜਾਂਦਾ ਹੈਗਾ ਆ ਇਸ ਦੀ ਦੇ ਸਾਨੂੰ ਐਲ ਪੀ ਜੀ ਗੈਸ ਦੀ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਬਹੁਤ ਸਾਰੀਆਂ ਸਾਵਧਾਨੀਆਂ ਦਾ ਸਾਹਮਣਾ ਵੀ ਕਰਨਾ ਚਾਹੀਦਾ ਹੈਗਾ ਆ ਕਿਉਂਕਿ ਜੇਕਰ ਅਸੀਂ ਗੈਸ ਨੂੰ ਇੱਦਾਂ ਹੀ ਖੁੱਲ੍ਹੇ ਛੱਡ ਦੇਵਾਂਗੇ ਤਾਂ ਜੇ ਅਸੀਂ ਉਚ ਦੇ ਨਾਲ ਅੱਗ ਲਗਾਵਾਂਗੇ ਤਾਂ ਫਿਰ ਸਾਡੇ ਪੂਰੇ ਘਰ ਦੇ ਵਿੱਚ ਅੱਗ ਵੀ ਲੱਗ ਸਕਦੀ ਹੈ ਜਿਸ ਕਰਕੇ ਬਹੁਤ ਨੁਕਸਾਨ ਹੋ ਸਕਦਾ ਹੈਗਾ ਹੈ ਅਤੇ ਜਾਨ ਜਾਣ ਦਾ ਵੀ ਖਤਰਾ ਹੈਗਾ ਹੈਗਾ ਹੈ ਇਸ ਕਰਕੇ ਸਾਨੂੰ ਐਲ ਪੀ ਜੀ ਗੈਸ ਸਲੰਡਰ ਦੀ ਵਰਤੋਂ ਕਰਦੇ ਸਮੇਂ ਬਹੁਤ ਸਾਰਾ ਧਿਆਨ ਰੱਖਣਾ ਚਾਹੀਦਾ ਹੈਗਾ ਹੈ ਅਸੀਂ ਕੋਈ ਵੀ ਜੇ ਅਸੀਂ ਗੈਸ ਦੇ ਕੰਮ ਕਰਦੇ ਹੈਗੇ ਹਾਂ ਅਤੇ ਸਾਡੇ ਆਲੇ ਦੁਆਲੇ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਹੈਗਾ ਹੈ ਕਿ ਖਿੜਕੀ ਦਰਵਾਜੇ ਖੁੱਲ੍ਹੇ ਹੋਏ ਹਨ ਬੰਦ ਤਾਂ ਨਹੀਂ ਹੈਗੀ ਆ ਜੇ ਅਸੀਂ ਗੈਸ ਦੀ ਵਰਤੋਂ ਕਰਦੇ ਹਾਂ ਅਤੇ ਗੈਸ ਨੂੰ ਇੱਦਾਂ ਹੀ ਓਪਨ ਛੱਡ ਦਿੰਦੇ ਹੈਗੇ ਹਾਂ ਅਤੇ ਬਾਅਦ ਵਿੱਚ ਆ ਕੇ ਉੱਥੇ ਕੋਈ ਵੀ ਮਾਚਿਸ ਦੇ ਨਾਲ ਜੇ ਕੋਈ ਅੱਗ ਲਗਾਉਂਦਾ ਹੈਗਾ ਆ ਤਾਂ ਪੂਰੇ ਘਰ ਦੇ ਵਿੱਚ ਵੀ ਅੱਗ ਲੱਗ ਸਕਦੀ ਹੈ ਜਿਸ ਕਰਕੇ ਸਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਸਾਨੂੰ ਐਲ ਪੀ ਜੀ ਗੈਸ ਸਲੰਡਰ ਦੀ ਵਰਤੋਂ ਕਰਦੇ ਸਮੇਂ ਬਹੁਤ ਸਾਰਾ ਧਿਆਨ ਰੱਖਣਾ ਪੈਂਦਾ ਹੈਗਾ ਹੈ ਅਤੇ ਇਸ ਦੇ ਨਾਲ ਸਾਡੇ ਟਾਈਮ ਦੀ ਬੱਚਤ ਵੀ ਹੁੰਦੀ ਹੈ